ਹੈਲੋ ਹਾਂਜੀ ਤੁਸੀਂ ਉਬਰ ਤੋਂ ਬੋਲ ਰਹੇ ਹੋ ਹਾਂ ਮੈਂ ਤੁਹਾਡੇ ਨਾਲ ਨਾ ਕਿਤੇ ਘੁੰਮਣ ਜਾਣਾ ਸੀਗਾ ਮੈਂ ਪਹਿਲਾਂ ਵੀ ਤੁਹਾਡੀ ਬੁਕਿੰਗ ਕਿੰਨੀ ਵਾਰੀ ਕੀਤੀ ਹੈ ਅਤੇ ਮੈਂ ਤਰਨ ਤਾਰਨ ਦੇ ਲਾਗੇ ਛਾਗੇ ਦੇ ਗੁਰਦੁਆਰੇ ਜਿੱਦਾਂ ਗੋਇੰਦਵਾਲ ਸਾਹਿਬ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਨੇ ਆ ਅਤੇ ਮੈਂ ਫਿਰ ਦੁਬਾਰਾ ਬੁਕਿੰਗ ਜਾਣੀ ਕਰਨੀ ਸੀ ਅਤੇ ਮੈਂ ਆਪਣੀ ਫੈਮਲੀ ਲੈ ਕੇ ਜਾਣੀ ਸੀ ਨਾਲ ਹਾਂਜੀ ਸ਼ਾਮ ਨੂੰ ਜਾਣਾ ਅਤੇ ਕਿੰਨੇ ਕੁ ਪੈਸੇ ਲੱਗਣਗੇ ਵਾਪਸੀ ਤੁਸੀਂ ਮੈਨੂੰ ਫਿਰ ਉੱਥੇ ਛੱਡਣਾ ਜਿੱਥੋਂ ਤੁਸੀਂ ਮੈਨੂੰ ਪਿੱਕ ਕਰਨਾ ਮੈਂ ਤਰਨ ਤਾਰਨ ਦੇ ਗੁਰਦੁਆਰੇ ਲਾਗੇ ਰਹਿੰਦਾ ਤੁਸੀਂ ਪਹਿਲਾਂ ਵੀ ਮੈਨੂੰ ਪਿੱਕ ਕੀਤਾ ਸੀਗਾ ਅਤੇ ਉੱਥੇ ਤੁਸੀਂ ਬਾਅਦ 'ਚੋਂ ਮੈਨੂੰ ਡਰੋਪ ਕਰਨਾ ਹਾਂਜੀ ਤੁਸੀਂ ਮੈਨੂੰ ਡਿਸਕਾਊਂਟ ਜ਼ਰੂਰ ਦੇ ਦਿਓ ਕਿਉਂਕਿ ਪਹਿਲਾਂ ਮੈਂ ਤੁਹਾਡਾ ਪੱਕਾ ਕਸਟਮਰ ਹਾਂ ਅਤੇ ਮੈਂ ਤੁਹਾਡੇ ਨਾਲ ਹੀ ਬੁਕਿੰਗ ਕਰਦਾ ਹਮੇਸ਼ਾ ਤੁਹਾਡੇ ਨਾਲ ਹੀ ਜਾਈਦਾ ਵਾ ਹਾਂਜੀ ਅਤੇ ਮੈਂ ਕਾਲੇ ਰੰਗ ਦੇ ਕੱਪੜੇ ਪਾਏ ਹੋਣਗੇ ਜੇ ਤੁਸੀਂ ਮੇਰੀ ਪਹਿਛਾਣ ਕਰਨੀ ਹੋਊਗੀ ਵੈਸੇ ਤੁਸੀਂ ਮੈਨੂੰ ਜਾਣਦੇ ਹੋ ਬਾਏ ਫੇਸ ਤੁਸੀਂ ਮੈਨੂੰ ਮਿਲੇ ਹੋਏ ਹੋ ਪਰ ਫਿਰ ਵੀ ਜੇ ਤੁਸੀਂ ਮੇਰੀ ਪਹਿਛਾਣ ਕਰਨੀ ਤਾਂ ਮੈਂ ਆਹ ਰੰਗ ਦੇ ਕੱਪੜੇ ਪਾਏ ਹੋਣਗੇ ਅਤੇ ਮੈਨੂੰ ਆਪਣਾ ਗੱਡੀ ਨੰਬਰ ਸੈਂਡ ਕਰ ਦਿਓ ਅਤੇ ਮੈਨੂੰ ਗੁਰਦੁਆਰੇ ਤੋਂ ਟਾਈਮ ਸਿਰ ਲੈ ਲਿਓ